ਮੈਂ ਚੰਡੀਗੜ੍ਹ ਸੈਕਟਰ ਪੰਦਰਾਂ ਦੇ ਕਲਾ ਕੇਂਦਰ ਵਿੱਚ ਗਈ ਸੀ ਉੱਥੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਆਪਣੀਆਂ ਤਸਵੀਰਾਂ ਦਾ ਪ੍ਰਦਰਸ਼ਨ ਕੀਤਾ ਹੋਇਆ ਸੀ ਜਿਸ ਵਿੱਚ ਸਾਡੇ ਇਲਾਕੇ ਵਿੱਚ ਰਹਿੰਦੀ ਕਲਾਕਾਰ ਜਸ਼ਨਦੀਪ ਕੌਰ ਦੁਆਰਾ ਬਣਾਈਆਂ ਤਸਵੀਰਾਂ ਵੀ ਪ੍ਰਦਰਸ਼ਿਤ ਕੀਤੀਆਂ ਹੋਈਆਂ ਸਨ ਉਸ ਵਿੱਚ ਉਸ ਦੁਆਰਾ ਬਣਾਈਆਂ ਤਸਵੀਰਾਂ ਇੱਕ ਤਰ੍ਹਾਂ ਨਾਲ਼ ਮੈਨੂੰ ਸੱਚਾਈ ਨਾਲ਼ ਭਰੀਆਂ ਦਿਸੀਆਂ ਇਹ ਤਸਵੀਰਾਂ ਬਹੁਤ ਵਧੀਆ ਸੁੰਦਰ ਅਤੇ ਰੋਜ਼ਾਨਾ ਜ਼ਿੰਦਗੀ ਦੀ ਸੱਚਾਈ ਨੂੰ ਬਿਆਨ ਕਰ ਰਹੀਆਂ ਸਨ ਮੈਂ ਉਨ੍ਹਾਂ ਦਾ ਕੰਮ ਦੇਖਣਾ ਬਹੁਤ ਪਸੰਦ ਕਰਦੀ ਹਾਂ ਮੈਂ ਉਹਨਾਂ ਦੀ ਤਸਵੀਰਾਂ ਬਣਾਉਣ ਦੀ ਕਲਾ ਤੋਂ ਬਹੁਤ ਪ੍ਰਭਾਵਿਤ ਹਾਂ